ਹਾਂਜੀ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਕੋਣ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਮੈਮ ਹੈਗਾ ਹੈਗਾ ਹਾਂਜੀ ਹਾਂਜੀ ਹੈਗਾ ਮੈਮ ਹਾਂਜੀ ਹਾਂਜੀ ਮੈਮ ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਹੈਲਪ ਚਾਹੀਦੀ ਹੈ ਉਹਦੇ ਲਈ ਸ ਮੈਡਮ ਇਹ ਗੁਰਦੁਆਰਾ ਹੁਣ ਡੇਰਾ ਬਾਬਾ ਨਾਨਕ ਬਲੋਕ ਦੇ ਵਿੱਚ ਮਿਲੂਗਾ ਜਦੋਂ ਆਪਾਂ ਗੁਰਦਾਸਪੁਰ ਬਾਈਪਾਸ ਤੋਂ ਐਂਟਰ ਕਰਦੇ ਹਾਂ ਨਾ ਜਿਹੜਾ ਪਠਾਨਕੋਟ ਤੋਂ ਅੰਮ੍ਰਿਤਸਰ ਵਾਲਾ ਬਾਈਪਾਸ ਹੈ ਉਹ ਤੋਂ ਆਪਾਂ ਸਿੱਧਾ ਐਂਟਰ ਕਰਕੇ ਆਪਾਂ ਗੁਰਦਾਸਪੁਰ ਨੂੰ ਆ ਜਾਂਦੇ ਹਾਂ ਅਤੇ ਜਿਸ ਤੋਂ ਆਪਾਂ ਉਹਨੂੰ ਲੈਫਟ ਟਰਨ ਕਰ ਜਾਈਏ ਅਤੇ ਉਹ ਡੇਰਾ ਬਾਬਾ ਨਾਨਕ ਨੂੰ ਚਲੀ ਜਾਂਦੀ ਹੈ ਅੱਗੇ ਜਾ ਕੇ ਉੱਥੇ ਅੱਗੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਮਿਲਣਗੇ ਚੋਲਾ ਸਾਹਿਬ ਗੁਰਦੁਆਰਾ ਉੱਥੇ ਬਾਏ ਬੱਸ ਵੀ ਜਾ ਸਕਦੇ ਹੋ ਔਰ ਤੁਸੀਂ ਬਾਏ ਕੈਬ ਵੀ ਤੁਸੀਂ ਉੱਥੇ ਜਾ ਸਕਦੇ ਹੋ ਕਾਫ਼ੀ ਫੇਮਸ ਗੁਰਦੁਆਰਾ ਬਹੁਤ ਜ਼ਿਆਦਾ ਉਹਦੀ ਉਹ ਹੈਗੀ ਮਾਨਤਾ ਹੈਗੀ ਆ ਉਹਦੇ ਵਿੱਚ ਉੱਥੇ ਗੁਰੂ ਹਾਂਜੀ ਹਾਂ ਵਧੀਆ ਉੱਥੇ ਇੱਥੇ ਕੀ ਸੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਨਾ ਆਪਣਾ ਚੋਲਾ ਤਿਆਗਿਆ ਹੋਇਆ ਕਾਫ਼ੀ ਫੇਮਸ ਹੈਕਾਫ਼ੀ ਮੇਲਾ ਵੀ ਉੱਥੇ ਕਾਫ਼ੀ ਲੱਗਦਾ ਹਾਂਜੀ ਹਾਂ ਵਧੀਆ ਹੈ ਗੁਰਦੁਆਰਾ ਉੱਥੇ ਤੁਸੀਂ ਜਾਓ ਨਹੀਂ ਮੈਮ ਮੇਰੇ ਕੋਲ ਐਕਚੁਲੀ ਟਾਈਮ ਨਹੀਂ ਹੈਗਾ ਮੈਂ ਨਹੀਂ ਜਾ ਸਕਦੀ ਤੁਸੀਂ ਜਾ ਕੇ ਆਓ ਤੁਸੀਂ ਬਾਏ ਕੈਬ ਚਲੇ ਜਾਓ ਉੱਥੋਂ ਕੋਈ ਵੀ ਡਰਾਈਵਰ ਬੁੱਕ ਕਰ ਲੋ ਤੁਸੀਂ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਲੈ ਜਾਏਗਾ ਉਹ ਕਾਫ਼ੀ ਸਾਰੇ ਗੁਰਦੁਆਰੇ ਉੱਥੇ ਤੁਸੀਂ ਸਾਰੇ ਸਾਰੇ ਗੁਰਦੁਆਰਾ ਉੱਥੇ ਵਿਜਿਟ ਕਰ ਸਕਦੇ ਹੋ ਹਾਂਜੀ ਹਾਂਜੀ ਹਾਂਜੀ